ਮੈਂ ਅੱਜ ਸਵੀਗੀ ਤੋਂ ਪੀਜ਼ਾ ਬਰਗਰ ਅਤੇ ਮੋਮੋਸ ਓਡਰ ਕੀਤੇ ਸੀ ਉਸ ਵੇਲੇ ਮੈਨੂੰ ਜਲਦੀ ਵੀ ਵਿੱਚੇ ਚੇਤਾ ਭੁੱਲ ਗਿਆ ਕਿਉਂਕਿ ਮੈਂ ਉੱਤੇ ਸਪੈਸ਼ਲ ਟੋਪਿੰਗਸ ਪਵਾਉਣਾ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਕਿ ਪੀਜ਼ੇ ਉੱਤੇ ਥੋੜ੍ਹੇ ਕ ਪਨੀਰ ਦੇ ਟੁੱਕੜੇ ਜ਼ਿਆਦਾ ਹੋਣ ਅਤੇ ਨਾਲ ਬਰਗਰ ਵਿੱਚ ਪਿਆਜ ਟਮਾਟਰ ਅਤੇ ਨਾਲ ਪਨੀਰ ਦੇ ਟੁੱਕੜੇ ਵੀ ਹੋਣ ਅਤੇ ਨਾਲ ਮੈਂ ਚਾਹੁੰਦਾ ਸੀ ਕਿ ਨਾਲ ਮੈਨੂੰ ਦੋ ਪੈਪਸੀ ਦੀ ਬੋਤਲਾਂ ਫ੍ਰੀ ਮਿਲ ਜਾਣ ਤਾਂ ਕਿ ਮੈਂ ਆਪਣੇ ਪਰਿਵਾਰ ਨਾਲ ਇੰਜੋਏ ਕਰ ਸਕਾਂ ਨਾਲ ਮੈਂ ਓਡਰ ਵੀ ਦੋ ਤਿੰਨ ਹਜ਼ਾਰ ਦਾ ਕੀਤਾ ਸੀ ਇਸ ਲਈ ਮੈਨੂੰ ਲੱਗਦਾ ਕਿ ਦੋ ਬੋਤਲਾਂ ਪੈਪਸੀ ਦੀ ਫ੍ਰੀ ਮਿਲਣੀਆਂ ਹੀ ਚਾਹੀਦੀਆਂ ਹਾਂ ਅਤੇ ਨਾਲ ਮੈਂ ਚਾਹੁੰਦਾ ਕਿ ਥੋੜ੍ਹਾ ਤਾਂ ਪੈਕਿੰਗ ਓਡਰ ਵਧੀਆ ਹੋਏ ਤਾਂ ਕਿ ਉਹ ਖ ਚੀਜ਼ਾਂ ਖ਼ਰਾਬ ਨਾ ਹੋਜੇ ਅਤੇ ਮੈਂ ਚਾਹੁੰਦਾ ਕਿ ਜਿਹੜਾ ਵੀ ਮੇਰੇ ਸਮਾਨ 'ਚ ਮਟੀਰੀਅਲ ਯੂਜ ਕੀਤਾ ਹੋਏ ਉਹ ਸਾਰਾ ਕੁਝ ਫਰੈਸ਼ ਹੀ ਹੋਣ ਤਾਂ ਕਿ ਮੇਰੇ ਪਰਿਵਾਰ ਨੂੰ ਥੋੜ੍ਹਾ ਖ਼ਰਾਬ ਖ਼ਰਾਬ ਨਾ ਲੱਗ ਜਾਵੇ ਅਤੇ ਨਾਲ ਮੈਂ ਚਾਹੁੰਦਾ ਕਿ ਜਲਦੀ ਤੋਂ ਜਲਦੀ ਆਹ ਓਡਰ ਮੇਰੇ ਘਰ ਭੇਜਿਆ ਜਾਏ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਖਾ ਸਕੀਏ